ਹਾਂਜੀ ਮੈਂ ਬੈਠ ਜਾਂਦੀ ਹਾਂ ਬੈਠ ਕੇ ਫਿਰ ਮੈਂ ਆਪਣੇ ਧਿਆਨ ਨਾਲ ਸੋਚਦੀ ਹਾਂ ਵੀ ਮੈਂ ਯੋਗਾ ਕਰਾਂ ਮੈਂ ਬੈਠਦੀ ਹਾਂ ਚੌਂਕੜੀ ਮਾਰ ਕੇ ਬਹਿ ਜਾਂਦੀ ਹਾਂ ਜੀ ਫਿਰ ਮੈਂ ਗੋਡਿਆਂ ਨੂੰ ਐਂ ਐਂ ਹਿਲਾਉਂਦੀ ਹਾਂ ਅਤੇ ਮੇਰੇ ਗੋਡਿਆਂ ਨੂੰ ਬਹੁਤ ਫਰਕ ਪਿਆ ਹੋਇਆ ਫਿਰ ਮੈਂ ਲੰਬੀ ਪੈ ਜਾਂਦੀ ਹਾਂ ਲੰਬੀ ਪੈ ਕੇ ਫਿਰ ਮੈਂ ਉਤਾਂਹ ਇਸ ਤਰ੍ਹਾਂ ਕਰਦੀ ਹਾਂ ਲੱਤਾਂ ਨੂੰ ਕਰਕੇ ਫਿਰ ਮੈਂ ਗੋਡਿਆਂ ਨੂੰ ਐਂ ਮੋੜਦੀ ਹਾਂ ਫਿਰ ਐਂ ਮੋੜਦੀ ਹਾਂ ਮੋੜ ਕੇ ਫਿਰ ਲੱਤ ਮੈਂ ਸਿੱਧੀ ਕਰਦੀ ਹਾਂ ਫਿਰ ਮੈਂ ਟੇਢੀ ਕਰਦੀ ਹਾਂ ਯੋਗਾ ਮੈਂ ਕਰਕੇ ਐਂ ਦੇਖਦੀ ਹਾਂ ਵੀ ਮੇਰਾ ਸਹੀ ਹੋ ਗਿਆ ਜਾਂ ਮੇਰਾ ਗਲਤ ਹੋ ਗਿਆ ਸਹੀ ਹੋ ਗਿਆ ਜੀ ਮੈਂ ਹੋਰ ਉਸ ਤਰ੍ਹਾਂ ਕਰ ਲੈਂਦੀ ਹਾਂ ਉਸ ਤਰ੍ਹਾਂ ਕਰਕੇ ਫਿਰ ਮੈਨੂੰ ਮਾੜਾ ਮੋਟਾ ਆਰਾਮ ਆ ਜਾਂਦਾ ਜੀ ਠੀਕ ਆ ਜੀ